ਹਾਂਜੀ ਮੈਂ ਮਨੋਰੰਜਨ ਗਤੀਵਿਧੀਆਂ ਦੀ ਸੂਚੀ ਦੇ ਸਕਦੀ ਹਾਂ ਅਤੇ ਉਸ ਵਿੱਚ ਸ਼ਾਮਿਲ ਵੀ ਹੁੰਦੀ ਹਾਂ ਮਨੋਰੰਜਨ ਲਈ ਮੈਂ ਆਪਣੇ ਖਾਲੀ ਸਮੇਂ ਵਿੱਚ ਬਹੁਤ ਕੁਛ ਕਰਦੀ ਹਾਂ ਜਿਵੇਂ ਕਿ ਮੈਂ ਟੀ ਵੀ ਦੇਖਦੀ ਹਾਂ ਜਿਸ ਵਿੱਚ ਪੰਜਾਬੀ ਮੂਵੀਆਂ ਵੀ ਚਲਦੀਆਂ ਹਨ ਅਤੇ ਉਸ ਵਿੱਚ ਮੈਂ ਮੇਰਾ ਬਹੁਤ ਮਨ ਲੱਗਦਾ ਹੈ ਅਤੇ ਮੋਬਾਈਲ ਵਿੱਚ ਵੀ ਮੈਂ ਬਹੁਤ ਅਖ਼ ਅਖ਼ਬਾਰਾਂ ਵੀ ਅਖਬਾਰਾਂ ਵਿੱਚ ਵਿੱਚ ਜੋ ਵੀ ਖਬਰਾਂ ਆਉਂਦੀਆਂ ਹਨ ਉਹ ਮੈਂ ਮੋਬਾਈਲ ਵਿੱਚ ਦੇਖ ਲੈਂਦੀ ਹਾਂ ਅਤੇ ਲਕ ਲੋਕ ਗੀਤ ਵੀ ਬਹੁਤ ਸੁਣਦੀ ਹਾਂ ਜਿਸ ਨਾਲ ਮੇਰਾ ਮਨ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਮੈਂ ਆਪਣੇ ਖਾਲੀ ਸਮੇਂ ਵਿੱਚ ਗਿੱਧਾ ਅਤੇ ਭੰਗੜਾ ਵੀ ਕਰਦੀ ਹਾਂ ਜਿਸ ਨਾਲ ਮੇਰਾ ਮਨੋਰੰਜਨ ਹੋ ਜਾਂਦਾ ਹੈ ਅਤੇ ਰੀਡਿੰਗ ਵੀ ਰੀਡਿੰਗ ਵੀ ਰੀਡਿੰਗ ਵਿੱਚ ਮੈਂ ਆਪਣੇ ਛੋਟੇ ਭਰਾ ਨੂੰ ਸ਼ਿਵ ਕੁਮਾਲ ਬਟਾਵਲੀ ਜਾਂ ਭਾਈ ਵੀਰ ਸਿੰਘ ਦੀ ਕਵਿਤਾਵਾਂ ਜਾਂ ਕਹਾਣੀਆਂ ਪੜ੍ਹ ਕੇ ਸੁਣਾਉਂਦੀ ਹਾਂ